ਮੈਨੂੰ ਯਾਤਰਾ ਕਰਨ ਦਾ ਬਹੁਤ ਹੀ ਜ਼ਿਆਦਾ ਸ਼ੌਕ ਹੈ ਅਤੇ ਮੈਂ ਵੱਖ ਵੱਖ ਜਗਾਵਾਂ ਉੱਤੇ ਯਾਤਰਾ ਕਰ ਚੁੱਕਾ ਹਾਂ ਅਤੇ ਇਹਨਾਂ ਯਾਤਰਾਵਾਂ ਦੇ ਵਿੱਚ ਕਈ ਵਾਰ ਬਹੁਤ ਹੀ ਜ਼ਿਆਦੀਆਂ ਚੁਣੌਤੀਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਉਹਨਾਂ ਵਿੱਚ ਜ਼ਿਆਦਾਤਰ ਚੁਣੌਤੀਆਂ ਪਹਾੜੀ ਵਾਲੀ ਖੇਤਰਾਂ ਵਿੱਚ ਸਾਹਮਣੇ ਆਉਂਦੀਆਂ ਹਨ ਕਿ ਜਦੋਂ ਅਸੀਂ ਪਹਾੜਾਂ ਵਾਲੇ ਏਰੀਏ ਦੇ ਵਿੱਚ ਜਾਂਦੇ ਹਾਂ ਤਾਂ ਉੱਥੇ ਖਾਣ ਪੀਣ ਦਾ ਸਮਾਨ ਜਿਵੇਂ ਮੈਗੀ ਹੋ ਗਿਆ ਰੋਟੀ ਵਗੈਰਾ ਹੋ ਗਈ ਜੋ ਇਹ ਸਭ ਚੀਜ਼ਾਂ ਹਨ ਕੋਲਡ ਡਰਿੰਕਸ ਹੋ ਗਈਆਂ ਇਹ ਬਹੁਤ ਹੀ ਮਹਿੰਗੇ ਰੁਪਏ ਦੇ ਵਿੱਚ ਸਾਨੂੰ ਮਿਲਦੀਆਂ ਹਨ ਕਿਉਂਕਿ ਉਹਨਾਂ ਦੇ ਪਹਾੜੀ ਏਰੀਏ ਦੇ ਵਿੱਚ ਇਹ ਜੋ ਸਮਾਨ ਹੈ ਬਹੁਤ ਹੀ ਮੁਸ਼ਕਲ ਦੇ ਨਾਲ ਪਹੁੰਚਦਾ ਹੈ ਜਿਸਦੇ ਕਾਰਨ ਇਹਨਾਂ ਦਾ ਪ੍ਰਾਈਜ਼ ਬਹੁਤ ਹੀ ਜ਼ਿਆਦਾ ਮਹਿੰਗਾ ਹੁੰਦਾ ਹੈ ਇਹ ਸਾਨੂੰ ਲੇਹ ਲਦਾਖ ਵਾਲੀ ਸਾਈਡ ਵਿਖੇ ਜੋ ਰਹਿਣ ਦੇ ਬੰਦੋਬਸਤ ਹਨ ਬਹੁਤ ਜ਼ਿਆਦਾ ਠੰਡ ਹੋਣ ਦੇ ਕਾਰਨ ਉੱਥੇ ਹੋਟਲਾਂ ਦੀ ਬਹੁਤ ਜ਼ਿਆਦੀ ਮੁਸ਼ਕਲ ਸਾਨੂੰ ਸਾਹਮਣੇ ਆਉਂਦੀ ਹੈ ਉੱਥੇ ਰਹਿਣ ਦਾ ਪ੍ਰਬੰਧ ਵੀ ਬਹੁਤ ਹੀ ਮੁਸ਼ਕਲ ਹੈ ਕਿਉਂਕਿ ਬਹੁਤ ਜ਼ਿਆਦਾ ਠੰਡ ਹੈ ਅਜਿਹੀਆਂ ਔਕੜਾਂ ਦਾ ਸਾਨੂੰ ਸਾਹਮਣਾ ਕਰਨਾ ਪੈਂਦਾ ਹੈ ਉੱਥੇ ਗੈਸ ਸਟੇਸ਼ਨ ਵੀ ਬਹੁਤ ਹੀ ਘੱਟ ਸੀਮਤ ਹੀ ਹਨ ਇਹ ਜ਼ਿਆਦਾ ਸਾਨੂੰ ਮੁਸ਼ਕਲਾਂ ਦਾ ਸਾਹਮਣਾ ਉਹਨਾਂ ਜਗਾਵਾਂ ਵਿਖੇ ਕਰਨਾ ਪੈਂਦਾ ਹੈ ਅਤੇ ਬਹੁਤ ਹੀ ਜ਼ਿਆਦਾ ਇਸ ਦੇ ਨਾਲ ਮੁਸ਼ਕਲ ਆਉਂਦੀ ਹੈ